ਹੈਲੋ ਸਤਿ ਸ਼੍ਰੀ ਅਕਾਲ ਜੀ ਵੀਰ ਮੈਂ ਹਰਪਿੰਦਰ ਸਿੰਘ ਬੋਲਦਾ ਜੀ ਕਯਾ ਤੁਸੀਂ ਕਰੇਸਟੈਸ ਤੋਂ ਬੋਲਦੇ ਹੋ ਹਾਂਜੀ ਵੀਰ ਮੈਂ ਅੱਜ ਸੁਬਾਹ ਥੌਤੇ ਦੋ ਵਾਈਟ ਸੌਸ ਪਾਸਤੇ ਅਤੇ ਦੋ ਪੀਜ਼ਿਆਂ ਦਾ ਆਰਡਰ ਕੀਤਾ ਸੀ ਅਤੇ ਮੈਨੂੰ ਵੀਰ ਕਿਸੇ ਕਾਰਨ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਪੈ ਰਿਹਾ ਹੈ ਜਿਸ ਕਰਕੇ ਮੈਂ ਤੁਹਾਡਾ ਆਰਡਰ ਨਹੀਂ ਰਸੀਵ ਕਰ ਸਕਦਾ ਸੋ ਕ੍ਰਿਪਾ ਕਰਕੇ ਮੇਰਾ ਆਰਡਰ ਕੈਂਸਲ ਕਰ ਦਿੱਤਾ ਜਾਵੇ ਅਤੇ ਜਿਹੜੀ ਮੇਰੀ ਬਣਦੀ ਪੇਅਮੈਂਟ ਹੈ ਜਿਹੜੀ ਮੈਂ ਤੁਹਾਨੂੰ ਅਡਵਾਂਸ਼ ਕੀਤੀ ਸੀ ਉਹ ਮੇਰੀ ਵਾਪਸ ਕਰ ਦਿਉ ਧੰਨਵਾਦ